ਦੋ ਜੁਲਾਈ ਦੋ ਹਜ਼ਾਰ ਇੱਕੀ ਪੰਦਰ੍ਹਾਂ ਸਤੰਬਰ ਉੱਨੀ ਸੌ ਪਚਾਨਵੇਂ ਪੰਦਰ੍ਹਾਂ ਨਵੰਬਰ ਉੱਨੀ ਸੌ ਉਣਾਨਵੇਂ ਦੋ ਜੁਲਾਈ ਉੱਨੀ ਸੌ ਚੁਰਾਨਵੇਂ ਬਾਰ੍ਹਾਂ ਨਵੰਬਰ ਉੱਨੀ ਸੌ ਤ੍ਰਿਆਨਵੇਂ